ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਜਿਵੇਂ ਪੰਜਾਬ ਦੇ ਸੱਭਿਆਚਾਰ ਦੇ ਕਿਹੜੇ ਮੁੱਖ ਤੱਤ ਹਨ ਜਿਹਨਾਂ ਦੇ ਤੁਹਾਨੂੰ ਸਭ ਤੋਂ ਵੱਧ ਮਾਣ ਹੈ ਸਾਡੇ ਸ ਪੰਜਾਬੀ ਸੱਭਿਆਚਾਰ ਬਾਰੇ ਬਹੁਤ ਬਹੁਤ ਹੀ ਬਥੇਰੇ ਨੇ ਜੋ ਕਿ ਜਿਵੇਂ ਕਿ ਉਹਨਾਂ ਦੇ ਵਿੱਚੋਂ ਮੇਨ ਆ ਜਾਂਦਾ ਸਾਡਾ ਭੰਗੜਾ ਭੰਗੜਾ ਵੀ ਜੋ ਕਿ ਸਾਨੂੰ ਮਾਣ ਹੁੰਦਾ ਜਿੱਥੇ ਵੀ ਜਾਈਏ ਅਸੀਂ ਭੰਗੜਾ ਜ਼ਿਆਦਾ ਦੇ ਪੰਜਾਬ ਅਤੇ ਬੁਢਲਾਡਾ ਵ ਵਾਸੀ ਹੋਣ ਦੇ ਦੇਖਦੇ ਹਾਂ ਵੀ ਜਿੱਥੇ ਵੀ ਸਾਡਾ ਭੰਗੜਾ ਆ ਜਾਏ ਜਾਂ ਪੰਜਾਬੀ ਬੋਲੀ ਬੋਲੇ ਤਾਂ ਉਹਦੇ 'ਤੇ ਸਾਨੂੰ ਮਾਣ ਹੁੰਦਾ ਵੀ ਸਾਡਾ ਸੱਭਿਆਚਾਰ ਆ ਰਿਹਾ ਵੀ ਸੱਭਿਆਚਾਰਕ ਦਰਸਾਉਂਦੇ ਨੇ ਸਾਡਾ ਜਾਂ ਕੁਛ ਵੀ ਕਰਦੇ ਨੇ ਅਤੇ ਸਭ ਤੋਂ ਮਾਣ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕਿ ਵਿਦੇਸ਼ਾਂ ਜਾਂ ਹੋਰ ਦੇਸ਼ ਜਾ ਕੇ ਜਦੋਂ ਦੇਖਦੇ ਹਾਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਜਾਂ ਹੋਰ ਵੀ ਅਸੀਂ ਬਥੇਰਾ ਕੁਛ ਦੇਖਦੇ ਹਾਂ ਅਤੇ ਪੰਜਾਬੀਆਂ ਦੇ ਭੰਗੜੇ ਪੈਂਦੇ ਨੇ ਜਾਂ ਹੋਰ ਢੋਲ ਵਗੈਰਾ ਵਜਾਉਂਦੇ ਨੇ ਉਹ ਇਹੋ ਜਿਹਾ ਕੁਛ ਦੇਖਦੇ ਹਾਂ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਪੰਜਾਬ ਦੇ ਵਾਸੀ ਹਾਂ ਅਤੇ ਬੁਢਲਾਡਾ ਦੇ ਰਹਿਣ ਵਾਲੇ ਹਾਂ ਧੰਨਵਾਦ